ਹਾਂ ਸਾਡੇ ਰਾਜ ਦੇ ਨੁਮਾਇੰਦਰੇ ਕਰਨ ਵਾਲੇ ਖੇਡਾਂ ਖੇਡ ਦੇ ਖਿਡਾਰੀ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ ਉਹ ਦੂਰ ਦੂਰ ਤੱਕ ਖੇਡਣ ਜਾਂਦੇ ਹਨ ਉਹਨਾਂ ਦੇ ਖੇਡਦਿਆਂ ਨੂੰ ਜ਼ਖਮੀ ਹੋ ਜਾਂਦੇ ਹਨ ਅਤੇ ਜ਼ਖਮੀ ਹੋਣਾ ਉਹਨਾਂ ਲਈ ਇੱਕ ਮਾਮੂਲੀ ਜਿਹੀ ਗੱਲ ਹੋ ਜਾਂਦੀ ਹੈ ਰਾਜ ਨੇ ਇਹ ਉਹਨਾਂ ਦੇ ਜ਼ਖਮੀ ਹੋਣ ਕਾਰਨ ਉਹਨਾਂ ਲਈ ਕਲੀਨਿੰਕ ਖੋਲ੍ਹੇ ਗਏ ਹਨ ਜਿਸ ਵਿੱਚ ਉਹਨਾਂ ਨੂੰ ਮੁਫਤ ਦਵਾਈ ਮੁਫਤ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਅਤੇ ਮੁਫਤ ਹੀ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਮੁਫਤ ਉਹਨਾਂ ਦੀ ਖਾਣ ਪੀਣ ਦਾ ਧਿਆਨ ਰੱਖਿਆ ਜਾਂਦਾ ਹੈ ਕਿਉਂਕਿ ਉਹ ਸਾਡੇ